ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਵੀਰੇ ਠੀਕ ਆ ਠੀਕ ਆ ਠੀਕ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਮੈਂ ਯਾਦਵਿੰਦਰਜੀਤ ਸਿੰਘ ਬੋਲਦਾ ਪਿਆ ਠੀਕ ਆ ਜੀ ਠੀਕ ਹੈ ਜੀ ਠੀਕ ਹੈ ਜੀ ਉਰੇ ਆਪਣੇ ਵੀਰੇ ਘੁੰਮਣ ਵਾਸਤੇ ਫਤਿਹਗੜ੍ਹ ਸਾਹਿਬ ਵੀਰੇ ਉਰੇ ਘੁੰਮਣ ਵਾਸਤੇ ਨਾ ਫਤਿਹਗੜ੍ਹ ਸਾਹਿਬ ਦੇ ਵਿੱਚ ਤਿੰਨ ਨੇ ਜੀ ਮੇਨ ਅਸਥਾਨ ਜੈਨ ਮੰਦਰ ਜਿਹੜਾ ਸ਼ਹੀਦੀ ਅਸਥਾਨ ਹੈ ਉਹ ਹੈਗਾ ਆਪਣਾ ਜੋਤੀ ਸਰੂਪ ਜੀ ਜੋਤੀ ਸਰੂਪ ਹੋ ਗਿਆ ਜੀ ਹੋਈ ਫਤਿਹਗੜ੍ਹ ਸਾਹਿਬ ਹੋ ਗਿਆ ਅਤੇ ਹਾਂਜੀ ਅੱਛਾ ਵੀ ਉਹਦੇ ਨਾਲ ਹੀ ਹੈਗਾ ਜੈਨ ਮੰਦਰ ਹਾਂਜੀ ਅਤੇ ਜਿਹੜਾ ਜੋਤੀ ਸਰੂਪ ਹੈ ਉੱਥੇ ਤਾਂ ਬਹੁਤ ਜਾਣੀ ਕਿ ਸੰਗਤ ਆਉਂਦੀ ਜੀ ਹਾਂ ਜੀ ਉੱਥੇ ਭਾਰੀ ਹੁੰਦਾ ਆਪਣਾ ਜਾਣੀ ਕਿ ਆਪਣਾ ਪੱਚੀ ਛੱਬੀ ਤਰੀਕਾਂ ਦਾ ਹੁੰਦਾ ਜੀ ਮੈਨੂੰ ਆਪਣਾ ਮੈਨ ਆਪਣਾ ਸ਼ੋਕ ਸਭਾ ਹੁੰਦੀ ਜੀ ਪੱਚੀ ਛੱਬੀ ਤਾਰੀਕ ਦੀ ਸ਼ੋਕ ਸਭਾ ਅਤੇ ਆਪਣਾ ਦੇਖ ਲਉ ਜੀ ਮਨ ਬਣਾ ਲਉ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਕਰ ਕਰਿਓ ਜ਼ਰੂਰ ਕਰਿਓ ਜੀ ਜ਼ਰੂਰ ਠੀਕ ਹੈ ਠੀਕ ਹੈ ਮੈਂ ਲਿਖ ਲੈਂਦਾ ਜੀ ਲਿਖ ਲੈਣਾ ਹਾਂਜੀ ਹਾਂਜੀ ਵੀਰੇ ਹੋਰ ਠੀਕ ਠਾਕ ਵਧੀਆ ਚੜ੍ਹਦੀ ਕਲਾ ਪਰਮਾਤਮਾ ਦਾ ਸ਼ੁਕਰੀਆ ਜੀ ਹੋਰ ਸੁਣਾਓ ਆਪ ਨਹੀਂ ਨਹੀਂ ਜੀ ਮੈਂ ਆਪਣਾ ਛੱਬੀ ਸਤਾਈ ਠ ਠਾਈ ਦਾ ਰੱਖੂਗਾ ਜੀ ਆਪਣਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਵੀਰੇ ਠੀਕ ਹੈ ਹਾਂਜੀ ਗੁਰਦੁਆਰਾ ਸਾਹਿਬ ਹੋ ਗਿਆ ਜੈਨ ਮੰਦਰ ਹੋ ਗਿਆ ਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਵੀਰੇ ਠੀਕ ਹੈ ਠੀਕ ਹੈ ਠੀਕ ਹੈ ਜੀ ਚਲੋ ਠੀ ਠੀਕ ਠੀਕ ਐ ਜੀ ਓਕੇ ਜੀ ਸਤਿ ਸ਼੍ਰੀ ਅਕਾਲ